ਭੰਗੜੇ ਦੇ ਕੁਛ ਆਮ ਸਟੈਪ ਕੀ ਹਨ ਅਤੇ ਉਹ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ ਭੰਗੜੇ ਦੇ ਕੁਛ ਆਮ ਸਟੈਪ ਜਿਵੇਂ ਝੁੰਮਰ ਲੁੱਡੀ ਜੁੱਲੀ ਧਣਕਾਰਾ ਧਮਾਲ ਆਦਿ ਹਨ ਇਹਨਾਂ ਦਾ ਭਰਾ ਪੰਜਾਬੀ ਸੱਭਿਆਚਾਰ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਹੈ ਜਿਵੇਂ ਕਿ ਇਹ ਜਸ਼ਨ ਵਾਲੇ ਸੁਭਾਅ ਵਿੱਚ